ਮੈਨੂੰ ਪਹਿਲੀ ਵਾਰੀ ਗਾਉਣ ਦੀ ਰੁਚੀ ਇਵੇਂ ਪੈਦਾ ਹੋਈ ਜਦੋਂ ਮੈਂ ਪੜ੍ਹਾਈ ਕਰਕੇ ਕੁਝ ਹੋਰ ਕਰਨਾ ਚਾਹੁੰਦੀ ਸੀ ਜਦੋਂ ਮੈਂ ਪੜ੍ਹਾਈ ਕਰਕੇ ਥੱਕ ਗਈ ਸੀ ਮੈਂ ਆਪਣਾ ਮਨ ਕਿਤੇ ਹੋਰ ਲਾਉਣਾ ਚਾਹੁੰਦੀ ਸੀ ਤਾਂ ਉਦੋਂ ਮੈਂ ਇੱਕ ਗਾਇਕ ਨੂੰ ਸੁਣਿਆ ਜਿਹਦਾ ਨਾਂ ਸਤਿੰਦਰ ਸਰਤਾਜ ਹ ਉਹਨੇ ਉਹਦਾ ਗਾਣਾ ਮੈਨੂੰ ਬੜਾ ਵਧੀਆ ਲੱਗਿਆ ਤੇ ਮੈਂ ਉਹਨਾਂ ਗਾਣਾ ਸੁਣ ਕੇ ਮੇਰੇ ਵੀ ਮਨ ਵਿੱਚ ਆਇਆ ਕਿ ਮੈਂ ਵੀ ਗਾਇਕੀ ਕਰਨਾ ਚਾਹੁੰਦੀ ਆਂ ਗਾਇਕੀ ਮੈਂ ਆਪਣੀ ਗਿਆਰਵੀਂ ਜਦੋਂ ਮੈਂ ਹੋਈ ਸੀ ਉਦੋਂ ਮੈਂ ਸ਼ੁਰੂ ਕਰ ਦਿੱਤੀ ਸੀਗੀ ਮੈਂ ਆਪਣੇ ਸਕੂਲ ਵਿੱਚ ਆਪਣੇ ਦੋਸਤਾਂ ਨਾਲ ਗਾਉਂਦੀ ਸੀ ਉਹ ਵੀ ਮੇਰਾ ਬੜਾ ਹੌਸਲਾ ਵਧਾਉਦੇ ਸਨ ਕੀ ਤੂੰ ਬੜੀਆਂ ਵਧੀਆ ਗਾਉਣੀ ਹ ਤੂੰ ਇਦਾਂ ਹੀ ਗਾਇਆ ਕਰ ਤੋ ਗਾਇਕੀ ਵਿੱਚ ਆਪਣਾ ਪ੍ਰਤਿਭਾ ਖੋਜ ਅਤੇ ਗਾਇਕੀ ਨੂੰ ਆਪਣੀ ਇੱਕ ਪਹਿਚਾਣ ਬਣਾ ਤੇ ਦੇਣ ਗਾਇਕੀ ਮੈਂ ਸਤਿੰਦਰ ਸਰਤਾਜ ਦੀ ਗਾਣੇ ਸੁਣ ਸੁਣ ਕੇ ਸਿੱਖੀ ਅਤੇ ਆਪਣੇ ਗਾਉਣੇ ਨੂੰ ਸ਼ੁਰੂ ਇਦਾਂ ਹੀ ਕਰ ਦਿੱਤਾ ਮੈਂ ਕਈ ਗਾਣੇ ਗਾਉਂਦੀ ਮੈਂ ਆਪਣੀ ਸਕੂਲ ਵਿੱਚ ਦੋਸਤਾਂ ਨੂੰ ਆਪਣੀ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਆਪਣੀ ਮਾਂ ਨੂੰ ਅਤੇ ਪਿਉ ਨੂੰ ਸੁਣਾਉਂਦੀ ਸੀ ਉਹਨਾਂ ਨੂੰ ਬੜਾ ਵਧੀਆ ਲੱਗਦਾ ਸੀ ਅਤੇ ਉਹ ਮੇਰਾ ਇਦਾਂ ਹੀ ਹੌਸਲਾ ਵਧਾਉਂਦੇ ਸਨ ਅਤੇ ਮੈਨੂੰ ਗਾਇਕੀ ਵਿੱਚ ਆਪਣੀ ਪ੍ਰਤਿਭਾ ਖੋਜਣ ਦਾ ਮੌਕਾ ਵੀ ਦਿੰਦੇ ਸਨ ਧੰਨਵਾਦ